ਸੈਲਫ਼ ਹੈਲਪ ਗਰੁੱਪ ਪਿੰਡਾਂ ਵ ਦੀਆਂ ਔਰਤਾਂ ਦੁਆਰਾ ਖੋਲ੍ਹੇ ਗਏ ਹਨ ਇਸ ਵਿੱਚ ਪੰਜ ਤੋਂ ਸੱਤ ਔਰਤਾਂ ਮਿਲ ਕੇ ਇੱਕ ਕੰਮ ਸ਼ੁਰੂ ਕਰਦੀਆਂ ਹਨ ਜਿਹੜੀ ਵੀ ਕਲਾ ਉਨ੍ਹਾਂ ਨੂੰ ਜਿਵੇਂ ਕਿ ਸਿਲਾਈ ਉਹਨਾਂ ਨੂੰ ਕਾਫ਼ੀ ਆਉਂਦੀ ਹੁੰਦੀ ਹੈ ਉਹ ਸਿਲਾਈ ਰਿਲੇਟਿਡ ਕੰਮ ਸ਼ੁਰੂ ਕਰਦੀਆਂ ਹਨ ਉਹ ਫੈਕਟਰੀ ਵਗੈਰਾ ਤੋਂ ਔਡਰ ਲੈ ਕੇ ਉੱਥੇ ਦੇ ਕੱਪੜੇ ਸੀਣੇ ਜਾਂ ਫਿਰ ਕੁਛ ਸ਼ਰਟਾਂ ਹੋ ਗਈਆਂ ਪੌਣੇ ਵਗੈਰਾ ਹੋ ਗਏ ਬੈਗ ਸੀਣੇ ਆਦਿ ਚੀਜ਼ਾਂ ਦਾ ਆਡਰ ਲੈ ਕੇ ਘਰ ਬੈਠੇ ਹੀ ਇਹ ਕੰਮ ਕਰਕੇ ਆਪਣੀ ਕਮਾਈ ਦਾ ਰੁਜ਼ਗਾਰ ਪੈਦਾ ਕਰਦੀਆਂ ਹਨ ਜਿਸ ਨਾਲ ਉਹ ਇੱਕ ਤਰ੍ਹਾਂ ਇਨਡਿਪੈਂਡਟ ਵੀ ਹੋ ਜਾਂਦੀਆਂ ਹਨ ਅਤੇ ਆਪਣਾ ਘਰੇਲੂ ਕੰਮ ਵੱਲ ਫੋਕ ਵੀ ਧਿਆਨ ਕਰ ਪਾਉਂਦੀਆਂ ਹਨ